ਅਸੀਂ ਨਾ ਪਿਛਲੇ ਦਿਨੀਂ ਇੱਕ ਸੋਫਾ ਖਰੀਦਿਆ ਜਿਸ ਵਿੱਚ ਨਾ ਕੋਰਨਰ ਵਾਲ਼ਾ ਸੋਫਾ ਸੀ ਨਾਲ਼ ਉਹਦੇ ਟੇਬਲ ਟੇਬਲ 'ਤੇ ਕੰਚ ਲੱਗਿਆ ਹੋਇਆ ਅਤੇ ਨਾਲ਼ ਉਹਨੇ ਸੋਫੇ ਸੈੱਟ ਨਾਲ਼ ਦਾ ਬੈੱਡ ਬਣਿਆ ਹੋਇਆ ਬੈੱਡ ਵੀ ਐਨ ਪ੍ਰੋਪਰ ਡਿਜ਼ਾਇਨਿੰਗ ਦੇ ਵਿੱਚ ਨਾਲ ਉਹਦੇ ਦੋ ਗੱਦੀਆਂ ਲੱਗੀਆਂ ਹੋਈਆਂ ਤੁਸੀਂ ਇੱਦਾਂ ਕਹਿ ਲਉ ਵੀ ਵਧੀਆ ਸੋਫਾ ਬਣਿਆ ਹੋਇਆ ਨਾਲ਼ ਉਹਦੇ ਗੱਦੀਆਂ ਸੋਫੇ ਦੇ ਤੁਸੀਂ ਹਿਸਾਬ ਲਾ ਲਓ ਵੀ ਨਾਈਨ ਸੀਟਰ ਸੋਫਾ ਦਸਵਾਂ ਹੋ ਗਿਆ ਬੈੱਡ ਨਾਲ਼ ਦੋ ਛੋਟੀਆਂ ਗੱਦੀਆਂ ਅਤੇ ਟੇਬਲ ਕੁੱਲ ਮਿਨਲ ਮਿਲਾ ਕੇ ਘੱਟੋ ਘੱਟ ਪੰਦਰ੍ਹਾਂ ਨਗ ਹੋਣੇ ਵੀ ਤੁਸੀਂ ਕਮਾਲ ਮੰਨੋ ਸਾਨੂੰ ਬਾਈ ਹਜ਼ਾਰ ਦੀ ਰੇਂਜ ਵਿੱਚ ਇੰਨਾਂ ਵਧੀਆ ਸੋਫਾ ਮਿਲ ਗਿਆ